ਹਾਂ ਬਈ ਇਹ ਦੱਸੋ ਵੀ ਜੇ ਕੁਝ ਮੌਸਮ ਦੀ ਖ਼ਰਾਬੀ ਹੋ ਜਾਵੇ ਤਾਂ ਉਸ ਸਮੇਂ ਸਾਨੂੰ ਅਸੀਂ ਕਿਸੇ ਦੂਰ ਸਥਾਨ 'ਤੇ ਹੋਈਏ ਤਾਂ ਸਾਡੇ ਲਈ ਉੱਥੇ ਰੈਸਟੋਰੈਂਟ ਤੁਹਾਡਾ ਮੌਸਮ ਦੇ ਮੁਤਾਬਕ ਅੱਜ ਕੱਲ੍ਹ ਦੇ ਜੋ ਮੌਸਮ ਚੱਲ ਰਿਹਾ ਹੈ ਉਸ ਦੀਆਂ ਸਬਜ਼ੀਆਂ ਜੋ ਚੱਲ ਰਹੀਆਂ ਉਹਨਾਂ ਦੇ ਨਾਲ਼ ਭੋਜਨ ਪ੍ਰਦਾਨ ਕਰ ਸਕਦਾ ਹੈ ਜਾਂ ਨਹੀਂ